ਹਾਂਜੀ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਜਿਹੜਾ ਹੈਗਾ ਆ ਅਤੇ ਲੋਕ ਧਾਰਾ ਪੰਜਾਬੀ ਭਾਸ਼ਾ ਸਾਹਿਤ ਸੱਭਿਆਚਾਰ ਅਤੇ ਪੰਜਾਬੀ ਲੋਕ ਧਾਰਾ ਦੇ ਖੇਤਰ ਬਾਰੇ ਮੈਂ ਮਤਲਬ ਮੇਰਾ ਇਹ ਮੇਰਾ ਮਤਲਬ ਕਹਿ ਲਉ ਕਿ ਮੇਰਾ ਪਸੰਦੀਦਾ ਮਤਲਬ ਖੇਤਰ ਹੈਗੇ ਨੇ ਇਹ ਇਹਨਾਂ ਬਾਰੇ ਮੈਂ ਵੱਧ ਤੋਂ ਵੱਧ ਜਾਨਣਾ ਚਾਹੁੰਦਾ ਅਤੇ ਇਹਨਾਂ ਬਾਰੇ ਮੈਂ ਲਿਖਦਾ ਵੀ ਅਤੇ ਲਿਖਣਾ ਚਾਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਅਤੇ ਖਾਸ ਕਰਕੇ ਉਹ ਜਿਹੜਾ ਮੇਰਾ ਅਪਰੋਚ ਹੁੰਦਾ ਐਨਾਲੀਟੀਕਲ ਵਿਸ਼ਲੇਸ਼ਣਾਤਮਕ ਨਜ਼ਰੀਏ ਤੋਂ ਮੈਂ ਚੀਜ਼ਾਂ ਨੂੰ ਲਿਖਦਾਂ ਔਰ ਮੈਂ ਆਪਣੇ ਕੁੱਲ ਸਮਾਜ ਨੂੰ ਖਾਸ ਕਰਕੇ ਪੰਜਾਬੀ ਸਮਾਜ ਜਿਹੜਾ ਹੈਗਾ ਏ ਆ ਉਹਨੂੰ ਅਸੀਂ ਮ ਮਨੁੱਖਤਾਵਾਦੀ ਨਜ਼ਰੀਏ ਤੋਂ ਇਹਨੂੰ ਸਹਿਹੋਂਦ ਅਸੀਂ ਕੋ ਐਗਜ਼ਿਸਟੈਂਸ ਜਿਹੜੀ ਹੈਗੀ ਆ ਓਹ ਕਿਵੇਂ ਦੁਨੀਆਂ ਦੇ ਵਿੱਚ ਬਰਕਰਾਰ ਜਿਹੜੀ ਉਹ ਰੱਖੀ ਜਾ ਸਕਦੀ ਹੈ ਤਾਂ ਜੋ ਸਮੁੱਚਾ ਦੁਨੀਆਂ ਦਾ ਮਨੁੱਖੀ ਭਾਈਚਾਰਾ ਜਿਹੜਾ ਹੈਗਾ ਆ ਓਹ ਇੱਕ ਪੀਸਫੁੱਲ ਜ਼ਿੰਦਗੀ ਜਿਹੜੀ ਹੈਗੀ ਹੈ ਇੱਕ ਮਤਲਬ ਬਿਹਤਰ ਮਨੁੱਖ ਸਿਰਜਨ ਦੀ ਜ਼ਿੰਦਗੀ ਜਿਹੜੀ ਹੈਗੀ ਹੈ ਓਹ ਓਹ ਸਿਰਜ ਸਕਣ ਸਾਰੇ ਜਾਣੇ ਅਸੀਂ ਰਲ ਕੇ ਇਸ ਕਿਸਮ ਨਾਲ ਮੈਂ ਕੁਛ ਗੱਲਾਂ ਜਿਹੜੀਆਂ ਨੇ ਉਹ ਪੜ੍ਹ ਕੇ ਸਮਝ ਕੇ ਅਤੇ ਓਹ ਲਿਖਣੀਆਂ ਚਾਹੁੰਦਾ ਇਹਨਾਂ ਨੂੰ ਮੈਂ ਪਸੰਦ ਕਰਦਾ ਥੈਂਕ ਯੂ